ਮੇਰੇ ਲਈ ਚਿੱਤਰਕਾਰੀ ਦਾ ਸਭ ਤੋਂ ਚੁਣੌਤੀਪੂਰਨ ਪਹਿਲੂ ਇਹ ਰਿਹਾ ਹੈ ਕਿ ਮੈਂ ਜਦੋਂ ਕਿਸੇ ਦੀ ਤਸਵੀਰ ਬਣਾਉਣਾ ਚਾਹੁੰਦੀ ਹਾਂ ਤਾਂ ਮਤਲਬ ਮੇਰੇ ਤੋਂ ਪਰਫੈਕਟ ਨਹੀਂ ਬਣੀ ਜਾਂਦੀ ਜਾਂ ਫਿਰ ਕਿਸੇ ਦੀ ਆਈਜ਼ ਆਈਜ਼ ਸਹੀ ਨਹੀਂ ਬਣਦੀਆਂ ਜਾਂ ਫਿਰ ਕਿਸੇ ਦਾ ਨੋਜ਼ ਸਹੀ ਨਹੀਂ ਬਣਦਾ ਜਾਂ ਫਿਰ ਕਿਸੇ ਦੀ ਆਈਬਰੋ ਸਹੀ ਨਹੀਂ ਬਣਦੀ ਜਿਸ ਕਰਕੇ ਮੈਂ ਕਿ ਮੈਨੂੰ ਥੋੜ੍ਹਾ ਮੁਸ਼ਕਿਲ ਜਿਹਾ ਲੱਗਦਾ ਕਰਨਾ ਬਟ ਮੈਂ ਫਿਰ ਵੀ ਬਾਰ ਬਾਰ ਅਭਿਆਸ ਕਰਦੀ ਰਹਿੰਦੀ ਹਾਂ ਕਿ ਮੈਂ ਕਦੇ ਨਾ ਕਦੇ ਤਾਂ ਸਹੀ ਬਣਾ ਪਾਊਂਗੀ ਇਸ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਔਖੀਆਂ ਨੱਕ ਅੱਖਾਂ ਜਾਂ ਔਖੀਆਂ ਲੱਗਦੀਆਂ ਹਨ ਜਾਂ ਫਿਰ ਬਾਲ ਜੋ ਕਿ ਸਹੀ ਤਰ੍ਹਾਂ ਨਹੀਂ ਬਣਦੇ ਜੋ ਕਿ ਅਗਲੇ ਬੰਦੇ ਦੇ ਸੇਮ ਹੁੰਦੇ ਹਨ ਉਵੇਂ ਦੇ ਸੇਮ ਨਹੀਂ ਬਣਦੇ ਥੋੜ੍ਹੇ ਬਹੁਤਾ ਕੁਛ ਨਾ ਕੁਛ ਰਹਿ ਜਾਂਦਾ ਪਰਫੈਕਟ ਬਣਾਉਣ ਲਈ ਔਰ ਔਰ ਅਭਿਆਸ ਕਰਨ ਲਈ ਮੈਂ ਵੱਧ ਤੋਂ ਵੱਧ ਪ੍ਰੈਕਟਿਸ ਕਰਦੀ ਰਹਿੰਦੀ ਹਾਂ ਤਾਂ ਕਿ ਮੈਂ ਆਪਣਾ ਸਹੀ ਤਰ੍ਹਾਂ ਇੰਪਰੂਵ ਕਰ ਪਾਵਾਂ